ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਅਤੇ ਮੈਂ ਜ਼ਿਲਾ ਬਠਿੰਡਾ ਤੋਂ ਬਿਲੋਂਗ ਕਰਦਾ ਗਾ ਮੈਂ ਸੈਂਟਰ ਯੂਨੀਵਰਸਿਟੀ ਦੇ ਵਿੱਚ ਜੋਬ ਕਰਦਾ ਸੀਗਾ ਅਤੇ ਸੈਂਟਰ ਯੂਨੀਵਰਸਿਟੀ ਦੇ ਵਿੱਚ ਮੈਂ ਪਿਛਲੇ ਅੱਠ ਨੌਂ ਸਾਲ ਤੋਂ ਕੰਮ ਕਰ ਰਿਹਾ ਜੀ ਅਤੇ ਸ ਸੈਂਟਰ ਯੂਨੀਵਰਸਿਟੀ ਵਿੱਚ ਜੋ ਵੀ ਸਟੋਰ ਦਾ ਵਰਕ ਹੈ ਉਹ ਮੈਂ ਦੇਖਦਾ ਹਾਂ ਜੋ ਵੀ ਨੋਨ ਕਨਸੁਮੋਲ ਐਟਮ ਕਨਸੁਮੇਵਲ ਐਟਮਾਂ ਸਟੇਸ਼ਨਰੀ ਹੋ ਗਈ ਇਸ਼ੂ ਕਰਦਾ ਸਟੇਸ਼ਨਰੀ ਇਸ਼ੂ ਕਰਨ ਵਾਸਤੇ ਬੋਚਰ ਲੈਣੇ ਪੈਂਦੇ ਆ ਜੋ ਕਿ ਸੈਂਟਰ ਯੂਨੀਵਰਸਿਟੀ ਦੇ ਵਿੱਚ ਇੱਕ ਨੋਟ ਬੁੱਕ ਅਸੀਂ ਇਸ਼ੂ ਕਰਦੇ ਹਾਂ ਅਤੇ ਉਸ ਬੁੱਕ ਦੇ ਰਾਹੀਂ ਅਸੀਂ ਸਮਾਨ ਜਾਨੀ ਕਿ ਐਚ ਓ ਡੀ ਦੇ ਸਾਇਨਾ ਦੇ ਆਧਾਰ 'ਤੇ ਅਸੀਂ ਸਮਾਨ ਦਿੰਦੇ ਹਾਂ ਸੋ ਜੋ ਬਰੋਕਰਸ ਸਮਾਨ ਹੋ ਜਾਂਦਾ ਖ਼ਰਾਬ ਸਮਾਨ ਹੋ ਜਾਂਦਾ ਹੈ ਉਹ ਵੀ ਅਸੀਂ ਇੱਥੇ ਸਟੋਰ ਦੇ ਵਿੱਚ ਮੈਨੇਜ ਕਰਦੇ ਹਾਂ ਉਹਨੂੰ ਈਵੇਸਟ ਦੇ ਵਿੱਚ ਵੇਚ ਦੇਣਾ ਜਾਂ ਫਿਰ ਕੈਮੀਕਲਾਂ ਦਾ ਜ ਜੋ ਵੀ ਸਮਾਨ ਆਉਂਦਾ ਹੈ ਸੈਂਟਰ ਯੂਨੀਵਰਸਿਟੀ ਦੇ ਵਿੱਚ ਉਹ ਵੀ ਮੈਂ ਹੀ ਦੇਖਦਾ ਹਾਂ ਅਤੇ ਜੋ ਵੀ ਇਸ ਰਜਿਸਟਰਾਂ ਦੀ ਮੈਨੇਜਮੈਂਟ ਹੈ ਉਹ ਵੀ ਮੈਂ ਦੇਖਦਾ ਹਾਂ ਨੋਨ ਕਨਜੁਮੇਵੱਲ ਦੇ ਜੋ ਡਾਟੇ ਨੂੰ ਆਪਡੇ ਅਪਡੇਟ ਕਰਦੇ ਹਾਂ ਜਿਸ 'ਚ ਉਹਨਾਂ ਨੂੰ ਵੀ ਮੈਂ ਹੀ ਦੇਖਦਾ ਹਾਂ ਸੋ ਕਾਫ਼ੀ ਜ਼ਿਆਦਾ ਮੇਰੇ ਕੋਲ ਇਸ ਟਾਈਮ ਵਰਕ ਹੈ